ਮੈਂ ਪੰਜਾਬ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਅਤੇ ਸਾਡੇ ਇੱਥੇ ਕੁਛ ਮੰਨੇ ਜਾਣ ਵਾਲੇ ਵਹਿਮ ਭਰਮ ਹਨ ਜਿਵੇਂ ਕਿ ਆਪਾਂ ਕਿਤੇ ਕ ਜ਼ਰੂਰੀ ਕੰਮ ਲਈ ਜਾਂਦੇ ਹੋਈਏ ਅਤੇ ਬਿੱਲੀ ਸਾਡਾ ਰਸਤਾ ਕੱਟ ਜਾਵੇ ਅਤੇ ਕਹਿੰਦੇ ਆ ਕਿ ਜਿਹੜਾ ਜੇ ਬਿੱਲੀ ਤੁਹਾਡਾ ਰਸਤਾ ਕੱਟ ਗਈ ਅਤੇ ਤੁਹਾਡਾ ਜਿਹੜਾ ਕੰਮ ਨਹੀਂ ਬਣਨਾ ਅਤੇ ਇਹੀ ਜੇ ਪੋਜ਼ੀਟਿਵ ਸੈਂਸ 'ਚ ਮੰਨਿਆ ਜਾਂਦਾ ਕਿ ਜੇ ਤੁਸੀਂ ਕਿਤੇ ਕੰਮ 'ਤੇ ਚੱਲੇ ਹੋਵੋਂ ਤੁਹਾਨੂੰ ਅੱਗੋਂ ਕੋਈ ਦੁੱਧ ਦਾ ਭਰਿਆ ਹੋਇਆ ਡੋਲੂ ਲੈ ਕੇ ਆਉਂਦਾ ਜਾਂ ਕੋਈ ਭਰਿਆ ਹੋਇਆ ਸਮਾਨ ਲੈ ਕੇ ਆਉਂਦਾ ਮਿਲ ਜਾਂਦਾ ਅਤੇ ਕਹਿੰਦੇ ਆ ਕਿ ਫਿਰ ਤੁਹਾਡਾ ਕੰਮ ਜਿਹੜਾ ਉਹ ਬਣ ਜਾਂਦਾ ਵੈ ਅਤੇ ਹੋਰ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਵੀਰਵਾਰ ਦਾ ਬੜਾ ਵਹਿਮ ਕੀਤਾ ਜਾਂਦਾ ਵੈ ਕਿ ਵੀਰਵਾਰ ਜਿਹੜੀਆਂ ਮਤਲਬ ਕੁੜੀਆਂ ਹੁੰਦੀਆਂ ਉਹਨਾਂ ਨੂੰ ਸਿਰ ਨਹੀਂ ਧੋਣ ਦਿੱਤਾ ਜਾਂਦਾ ਸਿਰ ਧੋਣਾ ਜਿਹੜਾ ਉਹ ਮਤਲਬ ਕਹਿੰਦੇ ਕਿ ਵਰਜਿਤ ਮੰਨਿਆ ਜਾਂਦਾ ਨਹੀਂ ਧੋਂਦੀਆਂ ਹੈਗੀਆਂ ਅਤੇ ਈਵਨ ਕੱਪੜੇ ਵੀ ਨਹੀਂ ਧੋਤੇ ਜਾਂਦੇ ਹੈਗੇ ਇੱਥੇ ਕਿੰਨੇ ਮਤਲਬ ਸਾਡੇ ਲਾਗੇ ਛਾਗੇ ਕੋਈ ਵੀ ਨਹੀਂ ਧੋਂਦਾ ਈਵਨ ਅਸੀਂ ਵੀ ਨਹੀਂ ਧੋਂਦੇ ਕਿ ਵੀਰਵਾਰ ਵਾਲੇ ਦਿਨ ਜਿਹੜੇ ਕੱਪੜੇ ਧੋਣੇ ਨਹੀਂ ਸ਼ੁਭ ਮੰਨਿਆ ਜਾਂਦੇ ਅਤੇ ਆਹ ਵੀ ਹੁੰਦਾ ਕਿ ਜਿਵੇਂ ਕੋਈ ਬੰਦਾ ਜਾਣ ਡਿਆ ਹੋਵੇ ਕਿਤੇ ਬਾਹਰ ਕੰਮ ਦੇ ਉੱਤੇ ਅਤੇ ਉਹਨੂੰ ਪਿੱਛੋਂ ਜੇ ਕੋਈ ਹਾਕ ਮਾਰ ਦੇਵੇ ਅਤੇ ਕਹਿੰਦੇ ਕਿ ਜੇ ਉਹਨੂੰ ਪਿੱਛੋਂ ਕਿਸੇ ਨੇ ਬੁਲਾ ਲਿਆ ਤਾਂ ਫਿਰ ਜਿਹੜਾ ਨਾ ਉਹ ਕੰਮ ਜਿਹੜਾ ਉਹ ਨਹੀਂ ਬਣਦਾ ਇੱਕ ਚੱਪਲ ਦਾ ਵੀ ਹੁੰਦਾ ਕਿ ਜਿਵੇਂ ਆਪਣੀ ਚੱਪਲ ਸਿੱਧੀ ਪਈ ਅਤੇ ਮੁੱਧੀ ਹੋ ਜਾਵੇ ਤਾਂ ਕੀ ਵੀ ਜੇ ਤੁਹਾਡੀ ਚੱਪਲ ਮੁੱਧੀ ਹੋ ਗਈ ਆ ਅਤੇ ਉਹਦੇ 'ਚ ਲੜਾਈ ਦਾ ਖ਼ਤਰਾ ਹੋ ਜਾਂਦਾ ਵੀ ਕਿਤੇ ਲੜਾਈ ਨਾ ਪੈ ਜਾਵੇ ਤੁਹਾਡੀ ਕਿਸੇ ਨਾਲ਼ ਅਤੇ ਇੱਕ ਆਹ ਵੀ ਹੁੰਦਾ ਕਿ ਜਿਵੇਂ ਆਪਾਂ ਕਿਸੇ ਚੰਗੇ ਕੰਮ 'ਤੇ ਚੱਲੇ ਹਾਂ ਅਤੇ ਘਰੋਂ ਤੁਸੀਂ ਚੀਨੀ ਅਤੇ ਦਹੀਂ ਖਾ ਕੇ ਨਿਕਲੋਂਗੇ ਤਾਂ ਤੁਹਾਡਾ ਕੰਮ ਜਿਹੜਾ ਉਹ ਬਣ ਜਾਏਗਾ ਅਤੇ ਇਹ ਕੁਝ ਮਤਲਬ ਇੱਦਾਂ ਦੇ ਵਹਿਮ ਭਰਮ ਜਿਹੜੇ ਨੇ ਉਹ ਸਾਡੇ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਮੰਨੇ ਜਾਂਦੇ ਹਨ